ਜੇ ਮੇਰੇ ਪਿੰਡ ਦੇ ਕਿਸੇ ਵਿਅਕਤੀ ਨੂੰ ਸੱਪ ਡੰਗ ਮਾਰ ਦਿੰਦਾ ਹੈ ਤਾਂ ਮੈਂ ਕੁਛ ਕਰਨ ਦਾ ਸਭ ਤੋਂ ਪਹਿਲੇ ਉਸ ਵਿਅਕਤੀ ਨੂੰ ਕਹਾਂਗਾ ਵੀ ਘਬਰਾਏ ਨਾ ਉਨ੍ਹਾਂ ਨੂੰ ਕਹਾਂਗਾ ਆਪਦੀ ਸਾਹ ਉੱਤੇ ਕਾਬੂ ਰੱਖੇ ਤੇ ਕੋਈ ਕੱਪੜੇ ਨਾਲ ਉਨ ਦੇ ਹੱਥ ਤੇ ਜਿੱਥੇ ਵੀ ਸੱਪ ਨੇ ਡੰਗ ਮਾਰਿਆ ਹੈ ਹੱਥ ਤੇ ਜਾਂ ਪੈਰ ਤੇ ਮਾਰਿਆ ਹੈ ਤੇ ਮੈਂ ਉਸ ਜਗਾ ਨੂੰ ਕੱਪੜੇ ਨਾਲ ਚੰਗੀ ਤਰ੍ਹਾਂ ਬੰਨਦਾ ਗਾ ਕੀ ਤਾਂ ਕੀ ਉਹ ਖੂਨ ਜਹਿਰੀਲਾ ਖੂਨ ਉਨ ਦੇ ਸ਼ਰੀਰ ਦੇ ਕਿਸੇ ਵੀ ਹੋਰ ਅੰਗ ਦੀ ਔਰ ਨਾ ਜਾਵੇ ਤੇ ਉਸਨੂੰ ਮੈਂ ਇੱਕ ਅੱਖਾਂ ਬੰਦ ਕਰਨ ਤੋਂ ਮਨਾਂ ਕਰਾਂਗਾ ਤਾਂ ਕੀ ਉਸ ਨੂੰ ਬੇਹੋਸ਼ੀ ਨਾ ਛਾਏ ਤੇ ਇਸ ਨਾਲੋਂ ਨਾਲ ਹੀ ਮੈਂ ਐਂਬੂਲੈਂਸ ਜਾਂ ਹਸਪਤਾਲ ਜਾਂ ਪੁਲਿਸ ਥਾਣੇ ਕਿਸੀ ਜਗਾ ਮੈਂ ਕੌਲ ਕਰਾਂਗਾ ਕੀ ਜਲਦ ਤੋਂ ਜਲਦ ਉਹਨੂੰ ਸਹਾਇਤਾ ਦਿੱਤੀ ਜਾਵੇ ਤੇ ਉਸਦਾ ਇਲਾਜ ਹੋਵੇ ਅਗਰ ਮੈਨੂੰ ਸਹਾਇਤਾ ਨਹੀਂ ਮਿਲਦੀ ਤਾਂ ਮੈਂ ਆਸ ਪਾਸ ਕਿਸੀ ਯਾਦਨ ਸਾਧਨ ਦੀ ਮਦਦ ਤੋਂ ਮੈਂ ਉਹਨੂੰ ਹਸਪਤਾਲ ਪਹੁੰਚਾਵਾਂਗਾ ਤੇ ਜਲਦ ਤੋਂ ਜਲਦ ਉਸਦਾ ਇਲਾਜ ਕਰਾਵਾਂਗਾ